ਸਾਡੇ ਇਲਾਕੇ ਵਿੱਚ ਕੁਝ ਕ ਕਈ ਤਰ੍ਹਾਂ ਦੀਆਂ ਰਸਮਾਂ ਹਨ ਹਰ ਹਰ ਧਰਮ ਦੀਆਂ ਵੱਖ ਵੱਖ ਰਸਮਾਂ ਹਨ ਇੱਥੇ ਹਰ ਧਰਮ ਵਿੱਚ ਜਨਮ ਤੋਂ ਲੈ ਕੇ ਮਰਨ ਤੱਕ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ ਇਹਨਾਂ ਦੇ ਇਹਨਾਂ 'ਤੇ ਰਸਮਾਂ ਤੋਂ ਸਾਡੇ ਭਾਈਚਾਰੇ ਬਾਰੇ ਪਤਾ ਲੱਗਦਾ ਹੈ ਅਤੇ ਸੱਭਿਅਤਾ ਦਾ ਪਤਾ ਲੱਗਦਾ ਹੈ ਕਈ ਤਰ੍ਹਾਂ ਦੀਆਂ ਧਰਮ ਧਰਮ ਧਾਰਮਿਕ ਰਸਮਾਂ ਵੀ ਹਨ ਜੋ ਕਿ ਉਦਾਹਰਨ ਲਈ ਵਰਤੀਆਂ ਜਾਂਦੀਆਂ ਹਨ ਕਈ ਸੈਲਾਨੀ ਬਾਹਰੋਂ ਆਉਂਦੀਆਂ ਹਨ ਅਤੇ ਇਹਨਾਂ ਰਸਮਾਂ ਨੂੰ ਦੇਖ ਕੇ ਬਹੁਤ ਆਨੰਦ ਲੈਂਦੇ ਹਨ ਉਹ ਇਹਨਾਂ ਵਿੱਚ ਸ਼ਾਮਿਲ ਵੀ ਹੋ ਸਕਦੇ ਹਨ ਕੋਈ ਰੋਕ ਰੋਕ ਟੋਕ ਨਹੀਂ ਹੈ